ਹੈਲੋ ਜੀ ਤੁਸੀਂ ਚਿੜੀਆ ਘਰ 'ਚ ਬੋਲਦੇ ਹੋ ਤੁਹਾਡੇ ਕੋਲ ਜੀ ਜਾਨਵਰ ਕਿਹੜੇ ਕਿਹੜੇ ਨੇ

ਅੱਛਾ ਜੀ ਕਿਹੜੇ ਕਿਹੜੇ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਹਾਂਜੀ ਅਸੀਂ ਜੀ ਅਬ ਦੇੇੇਖਣ ਆਉਣਾ ਸੀ ਜੀ ਸਾਨੂੰ ਬਹੁਤ ਸ਼ੌਂਕ ਹੈ ਦੇਖਣ ਦਾ ਨਾਲ ਅਸੀਂ ਬੱਚਿਆਂ ਨੂੰ ਦਖਾਉਣ ਆਉਣਾ ਸੀ ਹਾਂਜੀ ਤੁਹਾਡੇ ਕੋਲ ਹਿਰਨ ਬਾਰਾਂ ਸਿੰਗੇ ਹੈਗੇ ਹੈ ਜੀ ਜਿਰਾਫ਼ ਭਾਲੂ ਹੈਗਾ ਜੀ ਕਿੰਨੇ ਕਿੰਨੇ ਨੇ ਜੀ ਕਿੰਨੇ ਕਿੰਨੇ ਕ ਨੇ ਕਿੰਨੀ ਕਿਸਮ ਦੇ ਕਿਹੜੇ ਕਿਸਮ ਦੇ ਨੇ ਅੱਛਾ ਜੀ ਠੀਕ ਅ ਅਤੇ ਟਿਕਟ ਕਿੰਨੀ ਲੱਗਦੀ ਹੈ ਜੀ ਹਾਂਜੀ ਹਾਂਜੀ ਹਾਂਜੀ ਅਤੇ ਕੀ ਸਮਾਂ ਜੀ ਦੇਖਣ ਦਾ ਦੇਖਣ ਦਾ ਕੀ ਟੈਮ ਹੈ ਜੀ ਅੱਛਾ ਜੀ ਠੀਕ ਹੈ ਜੀ ਅਤੇ ਜਾਨਵਰਾਂ ਨੂੰ ਕੀ ਖਵਾਉਂਦੇ ਹੈ ਜੀ ਤੁਸੀਂ ਹਾਂਜੀ ਹਾਂਜੀ ਸ਼ੇਰ ਨੂੰ ਕੀ ਸ਼ੇਰ ਨੂੰ ਅੱਛਾ ਜੀ ਲੇ ਆਵਾਂਗੇ ਕੋਈ ਗੱਲ ਨਹੀਂ ਜੀ ਜਿਹੜਾ ਕੁਝ ਕਹੋਗੇ ਲੈ ਆਵਾਂਗੇ ਜਾਨਵਰਾਂ ਨੂੰ ਖਵਾਉਣ ਵਾਸਤੇ ਤੁਸ ਅੱਛਾ ਜੀ ਸ਼ੇਰ ਕੀ ਖਾਂਦਾ ਜੀ ਸ਼ੇਰ ਨੂੰ ਕੀ ਖਵਾਉਂਦੇ ਹੋ ਤੁਸੀਂ ਅੱਛਾ ਜੀ ਅੱਛਾ ਜੀ ਅਤੇ ਤੁਹਾਡੇ ਕੋਲ ਨੀਲ ਗਊਆਂ ਵੀ ਹੈਗੀਆਂ ਜੀ ਉਹ ਕਿੰਨੀਆਂ ਹੈ ਜੀ ਅੱਛਾ ਜੀ ਅਤੇ ਚਿੱਟੇ ਹਿਰਨ ਵੀ ਹੈਗੇ ਅੱਛਾ ਅਤੇ ਉਹ ਕਿੰਨੇ ਕਿੰਨੇ ਨੇ ਜੀ ਉਹ ਕਿੰਨੇ ਕਿੰਨੇ ਨੇ ਅੱਛਾ ਜੀ ਅੱਛਾ ਜੀ ਅਸੀਂ ਸੋਮਵਾਰ ਨੂੰ ਆਵਾਂਗੇ ਜੀ ਚੱਲੋ ਠੀਕ ਹੈ ਜੀ ਓਕੇ ਜੀ